ਹੈਲੋ ਸਰ ਤੁਸੀਂ ਸਾਡੀ ਐਪ ਤੇ ਟੈਕਸ ਮੇਸਿਜ ਕੀਤਾ ਸੀ ਓਕੇ ਸਰ ਪੁੱਛੋ ਤੁਸੀਂ ਕੀ ਪੁੱਛਣਾ ਸੀ ਹਾਂਜੀ ਸਾਰਾ ਇਥੇ ਹਰ ਕੁਛ ਹੀ ਆਨਲਾਈਨ ਕਲਾਸ ਮਿਲਦਾ ਹੈ ਜੀ ਓਕੇ ਸਰ ਹੋਰ ਕੁਝ ਪੁੱਛਣਾ ਤਾਂ ਪੁੱਛ ਸਕਦੇ ਹੋ ਹਾਂਜੀ ਹਾਂਜੀ ਸਰ ਜੋ ਵੀ ਪ੍ਰੋਡਕਟ ਮੰਗਾਉਣਾ ਇਥੋਂ ਸਭ ਤੇ ਡਿਸਕਾਊਂਟ ਮਿਲਦਾ ਹੈ ਹਾਂਜੀ ਸਰ ਹੋਰ ਕੁਝ ਪੁੱਛਣਾ ਜੋ ਵੀ ਤੁਸੀਂ ਪ੍ਰੋਡਕਟ ਬਾਏ ਕਰਨਾ ਚਾਹੁੰਦੇ ਹੋ ਉਹ ਕਿਹੜੀ ਲੋਕੇਸ਼ਨ 'ਤੇ ਭੇਜ ਦਿੱਤਾ ਜਾਵੇ ਓਕੇ ਸਰ ਓਕੇ ਸਰ ਹੋਰ ਕੁਝ ਓਕੇ ਸਰ ਜੋ ਵੀ ਪ੍ਰੋਡਕਟ ਮੰਗਵਾਉਣਾ ਹੈ ਤਾਂ ਸਾਡੀ ਐਪ 'ਤੇ ਟੈਕਸਟ ਮੇਸਿਜ ਕਰ ਸਕਦੇ ਹੋ ਅੱਗੇ ਤੋਂ ਵੀ ਓਕੇ ਸਰ ਥੈਂਕ ਯੂ ਜੀ